ਮੇਰੇ ਮਾਮਾ ਜੀ ਬਹੁਤ ਜ਼ਿਆਦਾ ਵਧੀਆ ਬਾਈਕਿੰਗ ਕਰਦੇ ਸਨ ਤਾਂ ਉਹਨਾਂ ਦੇ ਨਾਲ ਜਾ ਕੇ ਮੈਨੂੰ ਵੀ ਇਵੇਂ ਲੱਗਦਾ ਸੀ ਕਿ ਮੈਨੂੰ ਵੀ ਬਾਈਕਿੰਗ ਕਰਨੀ ਚਾਹੀਦੀ ਹੈ ਤਾਂ ਫਿਰ ਮੈਂ ਆਪਣੇ ਮਾਮਾ ਜੀ ਨੂੰ ਕਿਹਾ ਕਿ ਮੈਂ ਵੀ ਬਾਈਕਿੰਗ ਕਰਨੀ ਤਾਂ ਮੈਨੂੰ ਵੀ ਬਾਈਕ ਸਿਖਾ ਦਿਉ ਤਾਂ ਇਵੇਂ ਮਾਮਾ ਜੀ ਨੇ ਮੈਨੂੰ ਸਿਖਾਇਆ ਮੈਂ ਇੱਕ ਇੱਕ ਮਹੀਨਾ ਸਿੱਖਦਾ ਰਿਹਾ ਮਾਮਾ ਜੀ ਕੋਲੋਂ ਤਾਂ ਫਿਰ ਉਸ ਤੋਂ ਬਾਅਦ ਜਦੋਂ ਮੈਂ ਥੋੜ੍ਹਾ ਟਰੇਂਡ ਹੋਇਆ ਅਤੇ ਉਸ ਤੋਂ ਬਾਅਦ ਮੈਂ ਥੋੜ੍ਹਾ ਲੌਂਗ ਗਿਆ ਘੁੰਮਣ ਕਿ ਤਾਂ ਉਦੋਂ ਮੈਨੂੰ ਫੀਲ ਹੋਇਆ ਕਿ ਬਹੁਤ ਜ਼ਿਆਦਾ ਵਧੀਆ ਕਿ ਮੈਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬਾਈਕਿੰਗ ਕਰ ਸਕਦਾ ਹੋਰ ਦੂਰ ਤੱਕ ਜਾ ਸਕਦਾ ਤਾਂ ਇਵੇਂ ਥੋੜ੍ਹਾ ਟਾਈਮ ਹੋਰ ਹੋਇਆ ਤਾਂ ਮੈਂ ਥੋੜ੍ਹਾ ਜਨੂੰਨ ਜ਼ਿਆਦਾ ਪੈਦਾ ਹੋਇਆ ਤਾਂ ਇਸ ਤਰ੍ਹਾਂ ਮੈਂ ਥੋੜ੍ਹਾ ਜ਼ਿਆਦਾ ਲੋਂਗ ਜਾਂਦਾ ਰਿਹਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਵਧੀਆ ਬਾਈਕਿੰਗ ਕਰਨ ਲੱਗ ਗਿਆ ਤਾਂ ਮੈਂ ਹੁਣ ਮੈਂ ਕਾਫੀ ਜ਼ਿਆਦਾ ਦੂਰ ਤੱਕ ਘੁੰਮ ਆਉਂਦਾ ਬਾਈਕਿੰਗ ਜਦੋਂ ਕਰਦਾ ਹੋਰ ਵੀ ਇੱਕ ਦੋ ਫਰੈਂਡਸ ਮੇਰੇ ਨਾਲ ਜਾਂਦੇ ਨੇ ਉਹ ਵੀ ਕਹਿੰਦੇ ਕਿ ਤੂੰ ਬਹੁਤ ਜ਼ਿਆਦਾ ਵਧੀਆ ਬਾਈਕਿੰਗ ਕਰਦਾ ਤਾਂ ਉਹਨਾਂ ਨਾਲ ਬਹੁਤ ਜ਼ਿਆਦਾ ਦੂਰ ਤੱਕ ਬਾਈਕਿੰਗ ਕੀਤੀ ਹੈ ਬਹੁਤ ਜ਼ਿਆਦਾ ਘੁੰਮ ਕੇ ਆਏ ਹਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ